ਪੰਦਰ੍ਹਾਂ ਜੂਨ ਦੋ ਹਜ਼ਾਰ ਤਿੰਨ ਦਸ ਅਕਤੂਬਰ ਦੋ ਹਜ਼ਾਰ ਇੱਕ ਦਸ ਜਨਵਰੀ ਉੱਨੀ ਸੌ ਨੜਿਨਵੇਂ ਸਤਾਈ ਮਈ ਉੱਨੀ ਸੌ ਨੱਬੇ ਤੇਈ ਦਸੰਬਰ ਦੋ ਹਜ਼ਾਰ ਤਿੰਨ